ਪਸ਼ੂਆਂ ਦੇ ਗੋਬਰ ਅਤੇ ਮੂਤਰ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਪਸ਼ੂਆਂ ਪਸ਼ੂ ਜਿਹੜੇ ਪਰਮਾਤਮਾ ਨੇ ਸਾਨੂੰ ਇੱਕ ਅਨਮੋਲ ਚੀ ਅ ਅਨਮੋਲ ਵਸਤੂ ਦਿੱਤੇ ਹਨ ਪਸ਼ੂ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ ਜੇ ਕਿ ਇਹਨਾਂ ਇਹ ਜਦੋਂ ਮਤਲਬ ਕਿ ਇਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਜਾਂਦੀ ਹੈ ਸਾਨੂੰ ਦੁੱਧ ਵੀ ਦਿੰਦੇ ਹਨ ਦੁੱਧ ਦੇ ਨਾਲ ਨਾਲ ਸਾਨੂੰ ਗੋਬਰ ਦਿੰਦੇ ਹਨ ਗੋਬਰ ਦੇ ਨਾਲ ਗੋਬਰ ਨੂੰ ਕਈ ਤਰੀਕੇ ਨਾਲ ਯੂਜ ਕੀਤਾ ਜਾ ਸਕਦਾ ਹੈ ਨੰਬਰ ਇੱਕ 'ਤੇ ਅਸੀਂ ਗੋਬਰ ਦੇ ਨਾਲ ਆ ਆਪਣੇ ਜਿਹੜੇ ਪੇੜ ਪੌਦੇ ਹੁੰਦੇ ਹਨ ਉਹਨਾਂ ਨੂੰ ਖਾਦ ਦੇ ਤੌਰ 'ਤੇ ਯੂਜ ਕਰ ਸਕਦੇ ਹਾਂ ਉਹਨਾਂ ਦੁਆਰਾ ਬੜੀ ਵਧੀਆ ਖਾਦ ਬਣਾਈ ਜਾਂਦੀ ਹੈ ਜਿਹਦੇ ਨਾਲ ਪੌਦਿਆਂ ਦੀ ਗਰੋਥ ਬੜੀ ਚੰਗੀ ਤਰ੍ਹਾਂ ਨਾਲ ਹੁੰਦੀ ਹੈ ਤੁਸੀਂ ਉਸ ਨੂੰ ਮਿੱਟੀ ਦੇ ਵਿੱਚ ਰਲਾ ਕੇ ਉਹਦੇ ਵਿੱਚ ਮਿਕਸ ਕਰਕੇ ਮਿੱਟੀ ਦੇ ਵਿੱਚ ਰਲਾ ਕੇ ਤੁਸੀ ਬੂ ਆਪਣੇ ਗਮਲੇ ਜੋ ਤੁਸੀਂ ਘਰ ਦੇ ਬੂਟੇ ਬਾਟੇ ਲਾਏ ਹੁੰਦੇ ਹਨ ਉਹਨਾਂ ਦੇ ਵਿੱਚ ਪਾ ਸਕਦੇ ਹੋ ਏ ਇਹ ਇਹਦੀ ਇਹ ਮਾਲੀ ਵੀ ਇਹਨਾਂ ਦੀ ਵਰਤੋਂ ਕਰਨ ਵਾਸਤੇ ਕਹਿੰਦੇ ਹਨ ਤਾਂ ਜੋ ਪੌਦਿਆਂ ਨੂੰ ਬਹੁਤ ਸਾਰਾ ਮਤਲਬ ਕਿ ਉਹਨਾਂ ਦਾ ਵਿਕਾਸ ਹੋ ਸਕੇ ਗੋਬਰ ਦੀ ਵਰ ਨੰਬਰ ਦੋ 'ਤੇ ਗੋਬਰ ਦੀ ਵਰਤੋਂ ਪਹਿਲੇ ਜਮਾਨੇ ਦੇ ਵਿੱਚ ਲੋਕ ਆਪਣੇ ਘਰਾਂ ਨੂੰ ਮਤਲਬ ਕੋਠਿਆਂ ਨੂੰ ਪੋਚਣ ਵਾਸਤੇ ਫਰਸ਼ਾਂ ਨੂੰ ਪੋਚਣ ਵਾਸਤੇ ਕੀਤੀ ਜਾਂਦੀ ਸੀ ਪਹਿਲਾਂ ਉਹਨਾਂ ਦੇ ਘਰ ਕੱਚੇ ਹੁੰਦੇ ਸਨ ਅਤੇ ਕੱਚੇ ਘਰਾਂ ਨੂੰ ਪੋਚਣ ਵਾਸਤੇ ਵਧੀਆ ਬਣਾਉਣ ਵਾਸਤੇ ਗੋਬਰ ਦਾ ਪੋਚਾ ਲਗਾਇਆ ਜਾਂਦਾ ਸੀ ਕਈ ਲੋਕ ਕੋਠਿਆਂ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਸੀ ਅਤੇ ਨੰਬਰ ਤਿੰਨ 'ਤੇ ਗੋਬਰ ਦੀ ਵਰਤੋਂ ਆ ਅੱਜ ਕੱਲ੍ਹ ਦੇ ਮਤਲਬ ਕਿ ਮੱਛਰਾਂ ਦੇ ਟਾਈਮ ਵੀ ਮੱਛਰਾਂ ਦੇ ਤੋਂ ਬਚਾਅ ਵਾਸਤੇ ਵੀ ਕੀਤੀ ਜਾਂਦੀ ਹੈ ਇਸ ਨੂੰ ਜਲਾ ਕੇ ਘਰ ਵਿੱਚ ਰੱਖਿਆ ਜਾ ਸਕਦਾ ਹੈ ਡੇਂਗੂ ਵਰਗੇ ਮੱਛਰ ਤੋਂ ਇਸ ਤੋਂ ਜਲਾਉਣ ਨਾਲ ਡੇਂਗੂ ਵਰਗੇ ਮੱਛਰ ਤੋਂ ਬਚਿਆ ਜਾ ਸਕਦਾ ਹੈ ਇਸ ਦੇ ਇਸ ਨੂੰ ਜਲਾਉਣ ਨਾਲ ਮੱਛਰ ਨਹੀਂ ਆਉਂਦਾ ਘਰ ਦੇ ਵਿੱਚ ਕਿਉਂਕਿ ਇਹਦੀ ਖੁਸ਼ਬੂ ਮਤਲਬ ਕਿ ਇਹਦੀ ਸ ਖੁਸ਼ਬੂ ਨਾਲ ਹੀ ਸਾਰੇ ਘਰ ਦੇ ਵਿੱਚ ਮੱਛਰ ਗਾਇਬ ਹੋ ਜਾਂਦਾ ਹੈ ਨੰਬਰ ਚਾਰ 'ਤੇ ਪਹਿਲੇ ਪਿੰਡਾਂ ਦੇ ਵਿੱਚ ਗੋਬਰ ਗੁਬਾਰੇ ਬਣਾਏ ਜਾਂਦੇ ਸਨ ਗੁਬਾਰਿਆਂ ਦੇ ਵਿੱਚ ਪਾਥੀਆਂ ਗੋਬਰ ਦੀਆਂ ਪਾਥੀਆਂ ਬਣਾ ਕੇ ਇਹਨਾਂ ਨੂੰ ਰੱਖਿਆ ਜਾਂਦਾ ਸੀ ਫਿਰ ਉਹਨਾਂ ਪਾਥੀਆਂ ਨੂੰ ਜਦੋਂ ਸੁੱਕ ਜਾਂਦੀਆਂ ਸਨ ਸੁਕਾ ਕੇ ਫਿਰ ਉਹਨਾਂ ਦਾ ਬਾਲਣ ਬਣਾਇਆ ਜਾਂਦਾ ਸੀ ਬਾਲਣ ਬਾਲ ਕੇ ਚੁੱਲ੍ਹੇ ਦੇ ਵਿੱਚ ਲੋਕ ਇਹਨਾਂ ਦੇ ਨਾਲ ਬਾਲ ਕੇ ਅਤੇ ਇਹਨਾਂ ਦੇ ਉੱਪਰ ਰਖ ਰੋਟੀ ਸਬਜ਼ੀ ਜੋ ਵੀ ਬਣਾਈ ਸਾਗ ਲੋਕ ਬਣਾਉਂਦੇ ਸਨ ਇਹਨਾਂ ਦੇ ਉੱਪਰ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਦੋਂ ਗੈਸ ਵਗੈਰਾ ਨਹੀਂ ਹੁੰਦਾ ਸੀ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਫਿਰ ਸਾਰੇ ਘਰ ਦੇ ਮਤਲਬ ਕਿ ਸਿਹਤ ਠੀਕ ਰਹਿੰਦੀ ਸੀ ਸਰ ਅਤੇ ਗੋਬਰ ਦੀ ਇੰਨੀ ਵਧੀਆ ਵਰਤੋਂ ਕੀਤੀ ਜਾਂਦੀ ਹੈ ਗੋਬਰ ਤਾਂ ਸ ਸਾਰੇ ਹਰ ਤਰੀਕੇ ਨਾਲ ਯੂਜ ਕੀਤਾ ਉਸ ਤੋਂ ਬਾਅਦ ਮੁਰਗੀਆਂ ਦੀਆਂ ਬਿੱਠਾ ਮੁਰਗੀਆਂ ਦੀਆਂ ਬਿੱਠਾਂ ਜਿਹੜੀਆਂ ਨੇ ਜਿਸ ਇਹਦੇ ਵਿੱਚ ਮਤਲਬ ਕਿ ਉਸ ਜਗ੍ਹਾ 'ਤੇ ਦ ਦੱਬਿਆ ਜਾਂਦਾ ਜਿੱਥੇ ਨਾਈਟਰੋਜਨ ਦੀ ਘਾਟ ਹੁੰਦੀ ਹੈ ਨਾਈਟਰੋਜਨ ਦੇ ਵਿੱਚ ਇਹਨਾਂ ਦਾ ਯੂਜ ਕੀਤਾ ਜਾਂਦਾ ਹੈ ਇਹਨਾਂ ਦੀ ਬਿੱਠਾ ਵੀ ਯਾਨੀ ਜਾਨਵਰਾਂ ਦੇ ਹਰ ਇੱਕ ਮਤਲਬ ਕਿ ਜਿਹੜੀ ਵੇਸਟ ਪ੍ਰ ਵੇਸਟ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਇਹ ਇਸ ਅੰਤ ਵਿੱਚ ਇਹ ਕਿਹਾ ਜਾ ਸਕਦੀ ਜਿਹੜੇ ਜਾਨਵਰ ਵੀ ਜਿਹੜੇ ਜਾਨਵਰ ਪਸ਼ੂ ਪੰਛੀ ਸਾਡੇ ਵਾਸਤੇ ਬੜੀਆ ਵਧੀਆ ਚੀਜ਼ ਸਾਨੂੰ ਦੇ ਕੇ ਜਾਂਦੇ ਹਨ ਜਿਸ ਨਾਲ ਅਸੀਂ ਇਹਨਾਂ ਦਾ ਯੂਜ ਕਰ